ਪੰਜ ਜਨਵਰੀ ਦੋ ਹਜ਼ਾਰ ਛੇ ਪੰਜ ਜਨਵਰੀ ਦੋ ਹਜ਼ਾਰ ਸੱਤ ਛੇ ਜਨਵਰੀ ਦੋ ਹਜ਼ਾਰ ਨੌ ਅੱਠ ਅਗਸਤ ਦੋ ਹਜ਼ਾਰ ਦਸ ਬਾਰ੍ਹਾਂ ਅਗਸਤ ਦੋ ਹਜ਼ਾਰ ਪੰਜ